ਹਰ ਇੱਕ ਵਿਅਕਤੀ ਦੇ ਵਿੱਚ ਕੁਝ ਨਾ ਕੁਝ ਕਰਨ ਦੀ ਕਲਾ ਹੁੰਦੀ ਹੈ ਅਤੇ ਵਿਅਕਤੀ ਕਿਸੇ ਨਾ ਕਿਸੇ ਕੰਮ ਦੇ ਵਿੱਚ ਜ਼ਰੂਰ ਨਿਪੁੰਨ ਹੁੰਦਾ ਏ ਆ ਹਰ ਇੱਕ ਵਿਅਕਤੀ ਦੇ ਵਿੱਚ ਕੁਝ ਨਾ ਕੁਝ ਕਰਨ ਦੀ ਕਲਾ ਜ਼ਰੂਰ ਹੁੰਦੀ ਹੈ ਕੋਈ ਵਿਅਕਤੀ ਪੇਂਟਿੰਗ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਿਰ ਹੁੰਦਾ ਆ ਅਤੇ ਪੇਂਟਿੰਗ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਨਿਪੁੰਨਤਾ ਹਾਸਲ ਕਰਦਾ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪੇਂਟਿੰਗ ਕਰਦਾ ਹੈ ਅਤੇ ਕਿਸੇ ਇਸਤਰੀ ਦੇ ਵਿੱਚ ਕੱਪੜਿਆਂ ਨੂੰ ਸਿੱਖਣ ਦੀ ਬਹੁਤ ਹੀ ਜ਼ਿਆਦਾ ਇੱਛਾ ਹੁੰਦੀ ਹੈ ਅਤੇ ਉਹ ਕਲਾ ਦੇ ਵਿੱਚ ਬਹੁਤ ਹੀ ਜ਼ਿਆਦਾ ਨਿਪੁੰਨ ਹੁੰਦੀ ਹੈ ਅਤੇ ਉਹ ਕਲਾ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਕਰਦੀ ਹੈ ਅਤੇ ਉਹ ਕੱਪੜੇ ਸਿੱਖ ਕੇ ਕੱਪੜੇ ਬਣਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਅਤੇ ਉਸ ਖੇਤਰ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਨਿਪੁੰਨਤਾ ਹਾਸਲ ਕਰਦੀ ਹੈ ਇਸ ਕਰਕੇ ਕਿ ਕਲਾ ਹੀ ਹੁੰਦੀ ਹੈ ਜੋ ਵਿਅਕਤੀ ਵਧੀਆ ਤਰੀਕੇ ਦੇ ਨਾਲ ਉਸ ਕਲਾ ਨਾਲ ਸੰਬੰਧਿਤ ਕੰਮ ਕਰਦਾ ਆ ਅਤੇ ਉਹ ਵਿਅਕਤੀ ਜ਼ਿੰਦਗੀ ਦੇ ਵਿੱਚ ਨਿਪੁੰਨਤਾ ਹਾਸਲ ਕਰਦਾ ਹੈ